ਮੈਂ ਅਜੇ ਪਿੱਛੇ ਜਿਹੇ ਹੀ ਐਡੀਉਕਾਟ ਦੀ ਬਾਇਲੋਜੀ ਦੇ ਉੱਪਰ ਕਿਤਾਬਾਂ ਪੜ੍ਹੀਆਂ ਨੇ ਉਹਨਾਂ ਵਿੱਚ ਮੈਨੂੰ ਉਹਨਾਂ ਦੀ ਦਸਵੀਂ ਆਈ ਸੀ ਐੱਸ ਈ ਦੇ ਉੱਪਰ ਸੈਂਪਲ ਪੇਪਰ ਜਿਹਦੇ ਵਿੱਚ ਉਹਨਾਂ ਨੇ ਵਿਦਿਆਰਥੀਆਂ ਨੂੰ ਆਪਣੇ ਫਾਈਨਲ ਪੇਪਰ ਦੀ ਤਿਆਰੀ ਕਰਨ ਦੇ ਦੌਰਾਨ ਬੜੇ ਹੀ ਟਿਪਸ ਦਿੱਤੇ ਹੋਏ ਹਨ ਉਹਨਾਂ ਨੂੰ ਉਹਨਾਂ ਨੇ ਸਾਰੇ ਹੀ ਪੂਰੇ ਵਿਸ਼ੇ ਦੀ ਜਿਹੜਾ ਸਾਰਾ ਕਿਤਾਬ ਸੀ ਉਹਨੂੰ ਉਹਨਾਂ ਨੇ ਸਮਰਾਈਜ਼ ਕਰਕੇ ਛੋਟਾ ਕਰਕੇ ਸੰਖੇਪ ਵਿੱਚ ਜਿਹੜੇ ਉਹਦੇ ਮੇਨ ਮੇਨ ਪੁਆਇੰਟ ਸੀ ਉਹ ਸਾਰਾ ਕੁਛ ਬੱਚਿਆਂ ਦੇ ਲਈ ਲਿਖ ਦਿੱਤਾ ਬੱਚਿਆਂ ਨੂੰ ਫਿਰ ਇੱਕ ਦਿਨ ਦੇ ਵਿੱਚ ਆਪਣੇ ਫਾਈਨਲ ਇਮਤਿਹਾਨ ਤੋਂ ਪਹਿਲਾਂ ਉਹਨੂੰ ਇੱਕ ਦਿਨ ਦੇ ਵਿੱਚ ਪੜ੍ਹ ਕੇ ਉਹਦੇ ਵਿੱਚੋਂ ਸਾਰਾ ਕੁਛ ਸਮਝਣ ਲਈ ਬਹੁਤ ਹੀ ਅਸਾਨੀ ਹੋਈ ਉਹ ਕਿਤਾਬ ਮੈਂ ਇਸ ਵਾਰ ਵੀ ਆਪਣੇ ਬੱਚਿਆਂ ਨੂੰ ਰੈਕਮੈਂਡ ਕੀਤੀ ਹੈ ਉਹਦੇ ਵਿੱਚ ਵਿਸ਼ੇ ਦੇ ਉੱਪਰ ਬਹੁਤ ਹੀ ਬਾਰੀਕੀ ਦੇ ਨਾਲ ਪਰ ਸੰਖੇਪ ਦੇ ਵਿੱਚ ਸਾਰਾ ਕੁਛ ਲਿਖਿਆ ਹੋਇਆ ਹੈ